ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਆਪਾਂ ਦਿੱਲੀ ਏਅਰਪੋਰਟ 'ਤੇ ਪਹੁੰਚਣਾ ਸੀ ਅਤੇ ਆਪਾਂ ਨੂੰ ਹੁਣ ਇਹ ਜਾਮ ਵੀ ਪੈ ਗਿਆ ਤੁਸੀਂ ਦੇਖੋ ਭਾਈ ਸਾਹਿਬ ਕੋਈ ਨਵਾਂ ਕੋਈ ਹੋਰ ਰਸਤਾ ਜਿਹੜਾ ਆਪਾਂ ਉੱਥੇ ਟਾਈਮ ਇਸ ਨਿਕਲ ਸਕੀਏ ਇਸ ਰਸ਼ ਦੇ ਵਿੱਚੋਂ ਜਾਮ ਦੇ ਵਿੱਚੋਂ ਕਿਉਂਕਿ ਮੇਰੇ ਬੇਟੇ ਨੇ ਉੱਥੇ ਪਹੁੰਚ ਜਾਣਾ ਟਾਈਮ 'ਤੇ ਉਹਦੀ ਫਲਾਈਟ ਨੇ ਲੈਂਡ ਹੋ ਜਾਣਾ ਅਤੇ ਉਸ ਇਸ ਕਰਕੇ ਆਪਾਂ ਨੂੰ ਛੇਤੀ ਤੋਂ ਛੇਤੀ ਉੱਥੇ ਦਿੱਲੀ ਪਹੁੰਚੀਏ ਏਅਰਪੋਰਟ 'ਤੇ ਤਾਂ ਕਿ ਬੇਟੇ ਨੂੰ ਬਹੁਤਾ ਆਪਣਾ ਇੰਤਜ਼ਾਰ ਨਾ ਕਰਨਾ ਪਵੇ